ਵਾਲ ਅਤੇ ਚਮੜੀ ਨੂੰ ਦੇਖਭਾਲ ਕਰਨ ਲਈ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਪ੍ਰਸਿੱਧ ਘਰੇਲੂ ਨੁਸਖੇ ਹਨ ਜਿਹਨਾਂ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਵੇਂ ਪੁਰਾਣੇ ਸਿਆਣੇ ਲੱਸੀ ਦੇ ਨਾਲ ਸਿਰ ਧੋਣਾ ਅਤੇ ਚਮੜੀ ਦੀ ਦੇਖਭਾਲ ਕਰਨ ਦੇ ਲਈ ਪਹਿਲਾਂ ਤਾਂ ਅੰਦਰੂਨੀ ਜਿਹੜੇ ਤੱਤ ਆ ਉਹਨਾਂ ਦੀ ਪੂਰਤੀ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਵਿਟਾਮਿਨ ਸੀ ਦੀ ਪੂਰਤੀ ਲਈ ਸੰਗਤਰਾ ਐਲੋ ਵੇਰਾ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀ ਵਿਟਾਮਿਨ ਹੈ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਨਾਲ ਜਿਹੜੇ ਵਾਲ ਅਤੇ ਚਮੜੀ ਹੈ ਉਹ ਸੁਰਕਸ਼ਿਤ ਰਹਿੰਦੀ ਹੈ ਇਸਦੇ ਉਲਟ ਰੀਠੇ ਦੀ ਸਾਬਣ ਜਿਹੜੀ ਪੁਰਾਣੇ ਸਮੇਂ ਵਿੱਚ ਵੱਡੇ ਪੱਧਰ ਦੇ ਉੱਤੇ ਵਰਤੀ ਜਾਂਦੀ ਸੀ ਵਾਲਾਂ ਨੂੰ ਧੋਣ ਦੇ ਲਈ ਪੁਰਾਣੀਆਂ ਬੁੜੀਆਂ ਬਜ਼ੁਰਗਾਂ ਦੁਆਰਾ ਉਹ ਜਿਹੜੀ ਸਾਬਣ ਹੈ ਵਰਤ ਕੇ ਵਾਲਾਂ ਦੀ ਦੇਖਭਾਲ ਕੀਤੀ ਜਾਂਦੀ ਸੀ ਲੱਸੀ ਪੁਰਾਣੀ ਬੇਹੀ ਲੱਸੀ ਪੰਦਰ੍ਹਾਂ ਦਿਨ ਪੁਰਾਣੀ ਵੀਹ ਦਿਨ ਪੁਰਾਣੀ ਲੱਸੀ ਵਾਲਾਂ ਦੇ ਵਿੱਚ ਪਾ ਕੇ ਜਿਹੜੀ ਵਾਲਾਂ ਨੂੰ ਸਿੱਕਰੀ ਜਿਹਨੂੰ ਅੱਜ ਦੇ ਟਾਈਮ ਦੇ ਵਿੱਚ ਕਰ ਕਹਿੰਦੇ ਉਸ ਤੋਂ ਬਚਾ ਕੇ ਰੱਖਦੀ ਸੀ ਸੋ ਇਸ ਤਰ੍ਹਾਂ ਦੇ ਬਹੁਤ ਵੱਡੇ ਜਿਹੜੇ ਨੁਸਖੇ ਆ ਉਹ ਵਾਲ ਅਤੇ ਚਮੜੀ ਦੀ ਦੇਖਭਾਲ ਕਰਨ ਲਈ ਸਾਡੇ ਪਿੰਡਾਂ ਦੇ ਵਿੱਚ ਮਸ਼ਹੂਰ ਹਨ ਪਰ ਇਸ ਦੇ ਉਲਟ ਅੱਜ ਦੇ ਸਮੇਂ ਦੇ ਵਿੱਚ ਨਵੀਂ ਟੈਕਨੋਲੋਜੀ ਗਿਆਨ ਵਿਗਿਆਨ ਦੇ ਟਾਈਮ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਸ਼ੈਂਪੂ ਹੈ ਉਹ ਪਿੰਡਾਂ ਦੇ ਵਿੱਚ ਵਰਤਣੇ ਸ਼ੁਰੂ ਹੋ ਗਏ ਤਰ੍ਹਾਂ ਤਰ੍ਹਾਂ ਦੀਆਂ ਸਾਬਣਾਂ ਤਰ੍ਹਾਂ ਤਰ੍ਹਾਂ ਦੇ ਤੇਲ ਉਹ ਵਰਤੇ ਜਾਣ ਲੱਗ ਗਏ ਜਿਸ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਦਵਾਈਆਂ ਮੇਨ ਤੌਰ ਦੇ ਉੱਤੇ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਦੇ ਲਈ ਜਿਹੜੀਆਂ ਵਰਤਣੀਆਂ ਸ਼ੁਰੂ ਹੋ ਗਈਆਂ ਪੁਰਾਣੇ ਸਮਿਆਂ ਅਤੇ ਹੁਣ ਦੇ ਸਮਿਆਂ ਦੇ ਵਿੱਚ ਬਹੁਤ ਵੱਡਾ ਜਿਹੜਾ ਬਦਲਾਅ ਹੈ ਸਾਨੂੰ ਨਜ਼ਰ ਆਉਂਦਾ ਵਾਲਾਂ ਅਤੇ ਚਮੜੀ ਤੁਸੀਂ ਦੇਖਭਾਲ ਕਰਨ ਲਈ